ਮੈਂ ਪੰਜਾਬ ਤੋਂ ਹਾਂ ਅਤੇ ਪੰਜਾਬ ਵਿੱਚ ਜ਼ਿਆਦਾਤਰ ਲੋਕਾਂ ਦਾ ਜੋ ਅ ਰੋਟੀ ਦਾ ਰੁਜ਼ਗਾਰ ਹੈ ਉਹ ਖੇਤੀ ਹੀ ਹੈ ਪੰਜਾਬ ਵਿੱਚ ਅੱਧੇ ਤੋਂ ਜ਼ਿਆਦਾ ਲੋਕ ਹੈ ਜੋ ਖੇਤੀਬਾੜੀ 'ਤੇ ਹੀ ਨਿਰਭਰ ਹਨ ਉਹ ਖੇਤੀ ਉਗ ਖੇਤ ਜ਼ਮੀਨ ਵਿੱਚ ਖ ਫਸਲਾਂ ਬੀਜਦੇ ਹਨ ਅਤੇ ਉਸ ਫਸਲ ਤੋਂ ਬਾਅਦ ਜੋ ਪੈਸੇ ਆਉਂਦੇ ਉਸ ਉਸ ਨਾਲ ਹੀ ਆਪਣਾ ਘਰ ਦਾ ਗੁਜ਼ਾਰਾ ਕਰਦੇ ਹਨ ਪੰਜਾਬ ਇੱਕ ਪੰਜਾਬ ਪੰਜਾਬ ਵਿੱਚ ਬਹੁਤ ਸਾਰਾ ਅੰਨ ਉਗਾਇਆ ਜਾਂਦਾ ਹੈ ਅਤੇ ਪੰਜਾਬ ਸਿਰ ਉਹ ਅੰਨ ਆਪਣੇ ਲਈ ਹੀ ਨਹੀਂ ਬਾਕੀ ਹੋਰ ਦੇਸ਼ਾਂ ਦੇ ਵਿੱਚ ਵੀ ਭੇਜਦਾ ਹੈ ਅ ਆਪਣੇ ਵਿੱਚ ਅਤੇ ਆਪਣੇ ਹੋਰ ਦੇਸ਼ਾਂ ਨੂੰ ਤਾਂ ਭੇਜਦਾ ਹੀ ਹੈ ਅਤੇ ਅਪ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਭੇਜਿਆ ਜਾਂਦਾ ਕਿਉਂਕਿ ਨੌਰਥ ਇੰਡੀਆ ਹੀ ਹੈ ਜਿੱਥੇ ਮਤਲਬ ਵਧੀਆ ਫਸਲ ਉਪਜਾਈ ਜਾ ਸਕਦੀ ਹੈ ਹੁਣ ਖੇਤੀਬਾੜੀ ਕਰਨੀ ਅਗਰ ਕਿਸੇ ਨੇ ਵੀ ਤਾਂ ਉਹਨੂੰ ਮੇਨ ਸਭ ਤੋਂ ਪਹਿਲਾਂ ਸਾਧਨ ਜੋ ਚਾਹੀਦਾ ਹੈ ਜਿਸ ਨਾਲ ਖੇਤੀਬਾੜੀ ਹੋ ਸਕੇ ਜਿਸ ਤੋਂ ਬਿਨਾਂ ਹੋ ਹੀ ਨਹੀਂ ਸਕਦੀ ਉਹਨਾਂ ਦਾ ਸਾਧਨ ਹੈ ਉਹਨਾਂ ਕੋਲ ਪਾਣੀ ਹੋਣਾ ਚਾਹੀਦੇ ਪ ਅਗਰ ਬੰਦੇ ਕੋਲ ਜ਼ਮੀਨ ਤਾਂ ਹੈ ਲੇਕਿਨ ਉਸਦੇ ਕੋਲ ਖੇਤ ਨੂੰ ਪਾਣੀ ਲਾਉਣ ਵਾਸਤੇ ਕੋਈ ਸਾਧਨ ਨਹੀਂ ਉੱਥੇ ਉਸਦੇ ਖੇਤ ਤੱਕ ਪਾਣੀ ਨਹੀਂ ਪਹੁੰਚ ਰਿਹਾ ਤਾਂ ਉਸ ਜ਼ਮੀਨ ਦਾ ਵੀ ਉਸ ਨੂੰ ਕੋਈ ਫਾਇਦਾ ਨਹੀਂ ਤਾਂ ਪਾਣੀ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਦੇ ਬਹੁਤ ਸਾਰੇ ਸਰੋਤ ਹਨ ਲਾਈਕ ਲੋਕ ਪਾਣੀ ਕਿੱਦਾਂ ਆਪਣੇ ਖੇਤਾਂ ਨੂੰ ਪਾਣੀ ਕਿੱਦਾਂ ਪਹੁੰਚਾਉਂਦੇ ਹਨ ਅਤੇ ਕਿੱਦਾਂ ਆਪਣੇ ਖੇਤਾਂ ਨੂੰ ਪਾਣੀ ਲਗਾਉਂਦੇ ਹਨ ਬਹੁਤ ਸਾਰੇ ਸਾਧਨ ਹੈ ਜਿਸ ਨਾਲ ਖੇਤਾਂ ਵਿੱਚ ਪਾਣੀ ਲਾਇਆ ਜਾਂਦਾ ਹੈ ਕੁਛ ਲੋਕ ਬਹੁਤ ਸਾਰੇ ਲੋਕਾਂ ਨੇ ਆਪਣੇ ਮਤਲਬ ਖੇਤਾਂ ਵਿੱਚ ਟਿਊਬਵੈੱਲ ਲਗਾ ਰੱਖੇ ਹਨ ਜਿਸ ਨਾਲ਼ ਉਹ ਆਪਣੇ ਖੇਤਾਂ ਨੂੰ ਜਦ ਉਹਨਾਂ ਨੂੰ ਲੋੜ ਹੋਵੇ ਪਾਣੀ ਦਿੰਦੇ ਹਨ ਬਿਸਨ ਬਿਨਾਂ ਕਿਸੇ ਵੀ ਦਿੱਕਤ ਜਾਂ ਮੁਸ਼ਕਲ ਤੋਂ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹੜੇ ਪਾਣੀ ਵਾਸਤੇ ਆਪਣੇ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਬਾਰਿਸ਼ ਦੇ ਪਾਣੀ 'ਤੇ ਨਿਰਭਰ ਕਰਦੇ ਹਨ ਅਗਰ ਬਾ ਮੀਂਹ ਪੈ ਗਿਆ ਉਹਨਾਂ ਨੂੰ ਮਤਲਬ ਪਾਣੀ ਮਿਲ ਗਿਆ ਖੇਤਾਂ ਨੂੰ ਠੀਕ ਹੈ ਅਗਰ ਨਹੀਂ ਮਿਲਿਆ ਤਾਂ ਉਹਨਾਂ ਨੂੰ ਮਤਲਬ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਜਿਸ ਨਾਲ ਉਹ ਆਪਣੀ ਖੇਤਾਂ ਨੂੰ ਪਾਣੀ ਲਾ ਸਕੇ ਜੋ ਭਾਰਤ ਸਰਕਾ ਪੰਜਾਬ ਸਰਕਾਰ ਹੈ ਉਹ ਵੀ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਕਿ ਲੋਕਾਂ ਨੂੰ ਪਾਣੀ ਦਿੱਤਾ ਜਾ ਸਕੇ ਉਹ ਖੇਤੀ ਚੱਜ ਨਾਲ ਉਗਾ ਸਕੇ ਉ ਲੋਕਾਂ ਨੂੰ ਬਿਨਾਂ ਕਿਸੇ ਦਿੱਕਤ ਜਾਂ ਮੁਸ਼ਕਲ ਤੋਂ ਖੇਤੀਬਾੜੀ ਕਰ ਸਕਣ ਉਹਨਾਂ ਨੂੰ ਜੋ ਵੀ ਖੇਤੀਬਾੜੀ ਦੇ ਸਾਧਨ ਹੈ ਉਹ ਦਿੱਤੇ ਜਾ ਸਕਣ ਅਤੇ ਜੋ ਭਾਰਤ ਸਰਕਾਰ ਪੰਜਾਬ ਸਰਕਾਰ ਹੈ ਉਹ ਨਹਿਰ ਦਾ ਪਾਣੀ ਵੀ ਬਹੁਤ ਸਾਰੇ ਜ਼ਿਲ੍ਹੇ ਜਾਂ ਖੇਤਰਾਂ ਵਿੱਚ ਅ ਲੋਕਾਂ ਨੂੰ ਦਿੰਦੀ ਹੈ ਕਿ ਨਹਿਰ ਦਾ ਪਾਣੀ ਯੂਜ ਕਰਕੇ ਤੁਸੀਂ ਆਪਣੇ ਖੇਤਾਂ ਵਿੱਚ ਫਸਲ ਉਗਾ ਸਕੋ ਅਤੇ ਉਸ ਫਸਲ ਦਾ ਐਂਡ ਵਿੱਚ ਪੂਰਾ ਜੋ ਫਾਇਦਾ ਹੈ ਉਹ ਪੂਰੇ ਪੰਜਾਬ ਨੂੰ ਹੀ ਹੋਵੇਗਾ ਅਤੇ ਬਹੁਤ ਸਾਰੀਆਂ ਸਕੀਮਾਂ ਹੈ ਜਿਹੜੀ ਪੰਜਾਬ ਸਰਕਾਰ ਲੈ ਕੇ ਆਉਂਦੀ ਹੈ ਕਿ ਜੋ ਕਿਸਾਨਾਂ ਨੂੰ ਫਾਇਦਾ ਹੋ ਸਕੇ ਜਿੱਦਾਂ ਫਰੀ ਬਿਜਲੀ ਜੋ ਕਿਸਾਨ ਕਿਸਾਨ ਨੇ ਉਹਨਾਂ ਨੂੰ ਫਰੀ ਬਿਜਲੀ ਵੀ ਦਿੱਤੀ ਜਾਂਦੀ ਹੈ ਸਰਕਾਰ ਦੁਆਰਾ ਕਿ ਉਹ ਟਾਈਮ ਟੂ ਟਾਈਮ ਪਾਣੀ ਲਾ ਸਕੇ ਅਤੇ ਉਹਨਾਂ ਦੇ ਉੱਪਰ ਪੈਸੇ ਦਾ ਜਾਂ ਫਿਰ ਬਿਜਲੀ ਦਾ ਬਿੱਲ ਭਰਨ ਦਾ ਵੀ ਜ਼ਿਆਦਾ ਬੋਝ ਨਾ ਹੋਵੇ ਅਤੇ ਆਪਣੇ ਚੱਜ ਨਾਲ ਖੇਤੀ ਕਰ ਸਕੇ ਅਤੇ ਪੰਜਾਬ ਨੂੰ ਵਧੀਆ ਫਸਲਾਂ ਦੇ ਸਕੇ